ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਪੇੜ ਪੌਦਿਆਂ ਦਾ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਮਹੱਤਵ ਹੈ ਸਾਨੂੰ ਸਾਡੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਹੈ ਕਿ ਇਹਨਾਂ ਪੇੜ ਪੌਦਿਆਂ ਦੀ ਜ਼ਿਆਦਾ ਤੋਂ ਜ਼ਿਆਦਾ ਕੇਅਰ ਕਰਨੀ ਚਾਹੀਦੀ ਹੈ ਕਿਉਂਕਿ ਅਗਰ ਅਸੀਂ ਇਹਨਾਂ ਕੇਅਰ ਕਰਾਂਗਾ ਤਾਂ ਇਹ ਸਾਡੀ ਕੇਅਰ ਕਰਨਗੇ ਕਿਉਂਕਿ ਸਾਡੀ ਜ਼ਿੰਦਗੀ ਆ ਅਸੀਂ ਦੇਖ ਰਹੇ ਹਾਂ ਕਿ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਸਾਡਾ ਵਾਤਾਵਰਨ ਬਹੁਤ ਜ਼ਿਆਦਾ ਪ੍ਰਦੂਸ਼ਿਤ ਹੋ ਰਿਹਾ ਇਸ ਕਰਕੇ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਪੌਦੇ ਲਗਾਉਣੇ ਚਾਹੀਦੇ ਨੇ ਅਤੇ ਨਾਲ ਦੀ ਨਾਲ ਲਗਾਉਣ ਦੇ ਨਾਲ ਦੀ ਨਾਲ ਸਾਨੂੰ ਇਹਨਾਂ ਦੀ ਦੇਖਭਾਲ ਵੀ ਕਰਨੀ ਚਾਹੀਦੀ ਹੈ ਤਾਂ ਕਈ ਵਾਰ ਇੱਦਾਂ ਹੁੰਦਾ ਹੈ ਕਿ ਜਿਵੇਂ ਮੰਨ ਲਓ ਮੈਂ ਥੋੜ੍ਹੇ ਟਾਈਮ ਦੇ ਲਈ ਮੰਨ ਲਓ ਮੈਂ ਘਰੋਂ ਬਾਹਰ ਚਲਾ ਗਿਆ ਤਾਂ ਉਸ ਟਾਈਮ ਮੈਂ ਇਸ ਗੱਲ ਦਾ ਬਹੁਤ ਜ਼ਿਆਦਾ ਜਿਹੜਾ ਹੈਗਾ ਚੰਗੀ ਤਰ੍ਹਾਂ ਖਿਆਲ ਰੱਖਦਾ ਹੈਗਾ ਵੀ ਕਈ ਵਾਰ ਮੈਨੂੰ ਇੱਦਾਂ ਦੀ ਕੋਈ ਮੰਨ ਲਓ ਕੰਡੀਸ਼ਨ ਆ ਗਈ ਜਾਂ ਇੱਦਾਂ ਦੇ ਕੋਈ ਹਾਲਾਤ ਬਣ ਗਏ ਕਿ ਮੈਨੂੰ ਥੋੜ੍ਹੇ ਦਿਨਾਂ ਖਾਤਰ ਘਰ ਤੋਂ ਬਾਹਰ ਜਾਣਾ ਪੈ ਰਿਹਾ ਤਾਂ ਉਸ ਟਾਈਮ ਮੈਂ ਤਾਂ ਇੱਕ ਵਾਰ ਤਾਂ ਚਿੰਤਤ ਜ਼ਰੂਰ ਹੁੰਦਾ ਗਾ ਇੱਕ ਵਾਰ ਤਾਂ ਮੈਨੂੰ ਇੱਕ ਵਾਰ ਟੈਂਸ਼ਨ ਜ਼ਰੂਰ ਹੁੰਦੀ ਹੈ ਕਿ ਮੇਰੇ ਤੇ ਤੋਂ ਬਿਨਾਂ ਇਹਨਾਂ ਪੌਦਿਆਂ ਨੂੰ ਕੋਈ ਚੰਗੀ ਤਰੀਕੇ ਨਾਲ ਇਹਨਾਂ ਦਾ ਖਿਆਲ ਰੱਖ ਪਾਵੇਗਾ ਬਟ ਨਹੀਂ ਸਾਡੇ ਪਰਿਵਾਰ ਵਿੱਚ ਇੱਦਾਂ ਨਹੀਂ ਹੈ ਮੇਰੀ ਮਾਤਾ ਜੀ ਮੇਰੀ ਸਿਸਟਰ ਵੀ ਮੰਨ ਲਓ ਸਾਡਾ ਪੂਰਾ ਪਰਿਵਾਰ ਕਹਿ ਦਈਏ ਵੀ ਸ਼ੁਰੂ ਤੋਂ ਹੀ ਇਹਨਾਂ ਪੇੜ ਪੌਦੇ ਦੇ ਨਾਲ ਜੁੜਿਆ ਹੋਇਆ ਗਾ ਕਿਉਂਕਿ ਚਾਰੇ ਪਾਸੇ ਘਰ ਹਰੇ ਭਰੇ ਪੇੜ ਪੌਦੇ ਸੋਹਣੇ ਲੱਗਦੇ ਨੇ ਤਾਂ ਇੱਕ ਤਰ੍ਹਾਂ ਦਾ ਸਾਡੇ ਪਰਿਵਾਰ ਦੇ ਮੈਂਬਰ ਹੀ ਇਹ ਬਣ ਚੁੱਕੇ ਨੇ ਸੋ ਕਈ ਵਾਰ ਮੈਂ ਬਾਹਰ ਚਲਾ ਜਾਂਦਾ ਹਾਂ ਤਾਂ ਮੇਰੀ ਛੋਟੀ ਸਿਸਟਰ ਨੇ ਤਾਂ ਉਹ ਇਹਨਾਂ ਪੇੜ ਪੌਦਿਆਂ ਦੀ ਬਹੁਤ ਚੰਗੀ ਤਰ੍ਹਾਂ ਸੰਭਾਲ ਕਰਦੇ ਨੇ ਟਾਈਮ ਟੂ ਟਾਈਮ ਇਹਨਾਂ ਨੂੰ ਪਾਣੀ ਦਿੰਦੇ ਨੇ ਅਗਰ ਦੁਪਹਿਰੇ ਜ਼ਿਆਦਾ ਧੁੱਪ ਹੁੰਦੀ ਆ ਤਾਂ ਇਹਨਾਂ ਨੂੰ ਛਾਂਵੇ ਕਰ ਦਿੰਦੇ ਨੇ ਹੋਰ ਵੀ ਦੇਖਿਆ ਜਾਵੇ ਤਾਂ ਕਈ ਵਾਰ ਕੀ ਹੁੰਦਾ ਗਾ ਅਗਰ ਪੌ ਪੌਦਾ ਸੁੱਕ ਰਿਹਾ ਹੈਗਾ ਤਾਂ ਉਹਦੇ ਵਿੱਚ ਉਹਨੂੰ ਜ਼ਰੂਰੀ ਤੱਤ ਜਿਹੜੇ ਹੈਗੇ ਨੇ ਕਹਿ ਦਈਏ ਕੋਈ ਖਾਦ ਥੋੜ੍ਹੀ ਮੋਟੀ ਜਿੰਨੀ ਕੁ ਆਪ ਉਹਦੀ ਆਪਾਂ ਕਹਿ ਦਈਏ ਵੀ ਜਿੰਨੀ ਕਿ ਪੇੜ ਪੌਦੇ ਨੂੰ ਚਾਹੀਦੀ ਹੈ ਓਨੀ ਕੁ ਜ਼ਰੂਰਤ ਅਨੁਸਾਰ ਉਹਦੇ ਵਿੱਚ ਖਾਦ ਜਿਹੜੀ ਹੈਗੀ ਆ ਪਾ ਦੇਣੀ ਚਾਹੀਦੀ ਹੈ ਮਾਲੀ ਦੀ ਮੰਨ ਲਓ ਮਾਲੀ ਦੇ ਨਾਲ ਗੱਲ ਕਰਨ ਤੋਂ ਬਾਅਦ ਉਹਦੀ ਜਾਣਕਾਰੀ ਲੈਣ ਤੋਂ ਬਾਅਦ ਸਾਨੂੰ ਜਿਹੜੀ ਹੈਗੀ ਆ ਪੌਦੇ ਦੇ ਲਈ ਇਹ ਸਾਨੂੰ ਕਰਨਾ ਚਾਹੀਦਾ ਗਾ ਜਦੋਂ ਮੈਂ ਬਾਹਰ ਜਾਂਦਾ ਤਾਂ ਮੇਰੀ ਸਿਸਟਰ ਇਹਨਾਂ ਪੇੜ ਪੌਦਿਆਂ ਦੀ ਬਹੁਤ ਜ਼ਿਆਦਾ ਹੈਗੀ ਜਿਹੜੀ ਖਿਆਲ ਰੱਖਦੀ ਹੈ ਮੇਰੀ ਮਾਤਾ ਜੀ ਵੀ ਬਹੁਤ ਜ਼ਿਆਦਾ ਮੰਨ ਲਓ ਖਿਆਲ ਰੱਖਦੇ ਨੇ ਇਸ ਲਈ ਮੈਂ ਇੱਕ ਵਾਰ ਤਾਂ ਸ਼ੁਰੂ ਸ਼ੁਰੂ ਵਿੱਚ ਮੰਨ ਲਓ ਜਦੋਂ ਪੇੜ ਪੌਦੇ ਘਰ ਲਗਾਏ ਸੀ ਪਹਿਲੀ ਵਾਰ ਫਸਟ ਟਾਈਮ ਜਦੋਂ ਮੈਂ ਘਰੋਂ ਬਾਹਰ ਗਿਆ ਤਾਂ ਮੈਨੂੰ ਬਾਹਰ ਜਾ ਕੇ ਇੱਦਾਂ ਲੱਗਣ ਲੱਗਿਆ ਵੀ ਮੇਰੇ ਤੋਂ ਬਿਨਾਂ ਇੱਦਾਂ ਕਿੱਦਾਂ ਵੀ ਘਰਦੇ ਮਤਲਬ ਪਰੋਪਰ ਤਰੀਕੇ ਦੇ ਨਾਲ ਇਹਨਾਂ ਬੂਟਿਆਂ ਦੀ ਕੇਅਰ ਕਰ ਪਾਉਣਗੇ ਕਿਤੇ ਮੇਰੇ ਬੂਟੇ ਮੰਨ ਲਓ ਸੁੱਕ ਹੀ ਨਾ ਜਾਣ ਕਿ ਮੈਂ ਵਾਪਸ ਘਰ ਜਾਵਾਂ ਦੇਖਾ ਮੇਰੇ ਸੁ ਬੂਟੇ ਸੁੱਕ ਗਏ ਪਰ ਇੱਦਾਂ ਦਾ ਕੁਝ ਨਹੀਂ ਹੋਇਆ ਕਿਉਂਕਿ ਸਾਡੇ ਪਰਿਵਾਰ ਦੇ ਵਿੱਚ ਹਰ ਇੱਕ ਮੈਂਬਰ ਨੂੰ ਇੰਨਾਂ ਬੂਟਿਆਂ ਨਾਲ ਲਗਾਓ ਸੀਗਾ ਤਾਂ ਜਦੋਂ ਮੈਂ ਗਿਆ ਤਾਂ ਮੈਂ ਫੋਨ ਲਗਾ ਕੇ ਜਦੋਂ ਘਰ ਸਿਸਟਰ ਨਾਲ ਗੱਲ ਕਰਦਾ ਸੀ ਜਾਂ ਮਾਤਾ ਜੀ ਨਾਲ ਗੱਲ ਕਰਦਾ ਸੀ ਸ਼ਾਮ ਨੂੰ ਜਾਂ ਦੁਪਹਿਰੇ ਵੀ ਕਈ ਵਾਰ ਜ਼ਿਆਦਾ ਧੁੱਪ ਹੋਣ ਦੇ ਕਾਰਨ ਮੈਨੂੰ ਟੈਂਸ਼ਨ ਹੋ ਜਾਂਦੀ ਸੀ ਕਿ ਮੈਂ ਇੱਕ ਵਾਰ ਘਰ ਫੋਨ ਲਾ ਕੇ ਪੁਛਾਂ ਕਿ ਵੀ ਮੰਨ ਲਓ ਬੂਟੇ ਇਹਨਾਂ ਨੇ ਛਾਂਵੇ ਰੱਖੇ ਜਾਂ ਉੱਥੇ ਧੁੱਪੇ ਪਏ ਨੇ ਤਾਂ ਜਦੋਂ ਵੀ ਮੈਂ ਹਰ ਵਾਰ ਘਰ ਫੋਨ ਲਾ ਕੇ ਇੱਦਾਂ ਗੱਲ ਕੀਤੀ ਤਾਂ ਮੈਨੂੰ ਇਹੀ ਜਵਾਬ ਮਿਲਦਾ ਸੀ ਵੀ ਵੀਰ ਜੀ ਜਾਂ ਮੰਮੀ ਜੀ ਗੱਲ ਕਰਦੇ ਅਗਰ ਤਾਂ ਮੰਮੀ ਜੀ ਕਹਿੰਦੇ ਪੁੱਤਰ ਤੂੰ ਟੈਂਸ਼ਨ ਨਾ ਲੈ ਅਸੀਂ ਬੂਟਿਆਂ ਦਾ ਪੂਰਾ ਚੰਗੀ ਤਰ੍ਹਾਂ ਖਿਆਲ ਰੱਖ ਰਹੇ ਹਾਂ ਤਾਂ ਜਦੋਂ ਮੈਂ ਮੰਨ ਲਓ ਥੋੜ੍ਹੇ ਦਿਨਾਂ ਬਾਅਦ ਘਰ ਵਾਪਸ ਚਲਾ ਜਾਂਦਾ ਤਾਂ ਮੈਂ ਦੇਖਦਾ ਕਿ ਮੇਰੇ ਬੂਟੇ ਅੱਗੇ ਨਾਲੋਂ ਜ਼ਿਆਦਾ ਹੋਰ ਸੁੰਦਰ ਅਤੇ ਮੰਨ ਲਓ ਕਹਿਣ ਦਾ ਭਾਵ ਕੀ ਆ ਡਿਵੈਲਪ ਹੋ ਰਹੇ ਨੇ ਕੋਈ ਇੱਦਾਂ ਜਿੱਦਾਂ ਦਾ ਮੈਂ ਚਿੰਤਿਤ ਹੋ ਰਿਹਾ ਸੀ ਮੈਨੂੰ ਡਰ ਲੱਗ ਰਿਹਾ ਸੀ ਮੇਰੇ ਬੂਟੇ ਸੁੱਕ ਨਾ ਜਾਣ ਇੱਦਾਂ ਦਾ ਕੁਝ ਨਹੀਂ ਸੀ ਘਰ ਆ ਕੇ ਦੇਖੇ ਤਾਂ ਬੂਟੇ ਬਹੁਤ ਜ਼ਿਆਦਾ ਸੁੰਦਰ ਲੱਗ ਰਹੇ ਸੀਗੇ ਅੱਗੇ ਤੋਂ ਜ਼ਿਆਦਾ ਹੋਰ ਗਰੋਥ ਕਰ ਚੁੱਕੇ ਸੀ ਬੂਟੇ ਤਾਂ ਇਸ ਲਈ ਸਾਡੇ ਇਕੱਲਾ ਇਕੱਲਾ ਮੈਂਬਰ ਜੋ ਹੈਗੇ ਆ ਚੰਗੀ ਤਰਾਂ ਬੂਟਿਆਂ ਦੀ ਦੇਖਭਾਲ ਕਰ ਰਿਹਾ ਸੀਗਾ ਇਸ ਤਰ੍ਹਾਂ ਹਰ ਇੱਕ ਦੇ ਘਰ ਇੱਦਾਂ ਹੀ ਕਰਨਾ ਚਾਹੀਦਾ ਹੈ ਬੂਟਿਆਂ ਦੇ ਨਾਲ ਲਗਾਓ ਰੱਖਣਾ ਚਾਹੀਦਾ ਹੈ ਇੱਦਾਂ ਨਹੀਂ ਕਿ ਅਸੀਂ ਇੱਕ ਵਾਰ ਬੂਟਾ ਲਗਾਇਆ ਤਾਂ ਚਲੋ ਜੀ ਆਪ ਹੀ ਇਹ ਬੂਟਾ ਵੱਡਾ ਹੋਜੂ ਇੱਦਾਂ ਨਹੀਂ ਕਰਨਾ ਚਾਹੀਦਾ ਉਹਦੀ ਪ੍ਰੋਪਰ ਸਾਨੂੰ ਦੇਖਭਾਲ ਕਰਨੀ ਚਾਹੀਦੀ ਹੈ ਬੂਟੇ ਘੱਟ ਲਗਾ ਲਓ ਪਰ ਬੂਟੇ ਨੂੰ ਚੰਗੀ ਤਰ੍ਹਾਂ ਪਾਲੋ ਕਿਉਂਕਿ ਇਹ ਇਨ ਫਿਊਚਰ ਸਾਨੂੰ ਇਹੀ ਜਿਹੜਾ ਹੈਗੇ ਆ ਅੱਗੇ ਸਾਡੇ ਜ਼ਿੰਦਗੀ ਨਾਲ ਬਹੁਤ ਚੰਗਾ ਲਗਾਓ ਬਣਦਾ ਹੈਗਾ ਸਾਡੇ ਲਈ ਬੜੀ ਮਾਣ ਮਹਿਸੂਸ ਹੁੰਦਾ ਜਦੋਂ ਅਸੀਂ ਮੰਨ ਲਓ ਇੱਕ ਛੋਟਾ ਜਿਹਾ ਬੂਟਾ ਪਾਲਦੇ ਹਾਂ ਜਦੋਂ ਉਹ ਸਾਡੇ ਸਾਹਮਣੇ ਵੱਡਾ ਵੱਡਾ ਹੋ ਕੇ ਵੱਡਾ ਹੋਰ ਵੱਡਾ ਹੋ ਜਾਂਦਾ ਤਾਂ ਅਸੀਂ ਆਪਣੇ ਆਪ 'ਤੇ ਗਰਵ ਮਹਿਸੂਸ ਕਰਦੇ ਹਾਂ ਵੀ ਹਾਂ ਮੇਰਾ ਬੂਟਾ ਪਾ ਪਾਲਿਆ ਹੋਇਆ ਅੱਜ ਮੈਂ ਇਹਦੇ ਬੂਟੇ ਦੇ ਮੰਨ ਲਓ ਜਦੋਂ ਪੇੜ ਬਣਦਾ ਅਸੀਂ ਮਾਨ ਮਹਿਸੂਸ ਕਰਦੇ ਹਾਂ ਵੀ ਇਸ ਥੱਲੇ ਬਹਿ ਕੇ ਜਦੋਂ ਸਾਹ ਲੈਂਦੇ ਠੰਡੇ ਸਾਹ ਲੈਂਦੇ ਆ ਤਾਂ ਸਾਨੂੰ ਇੱਕ ਮਾਨ ਮਹਿਸੂਸ ਹੁੰਦਾ ਵੀ ਹਾਂ ਇਹ ਉਹੀ ਬੂਟਾ ਜੋ ਮੈਂ ਛੋਟਾ ਹੁੰਦੇ ਛੋਟਾ ਹੁੰਦਾ ਪਾਲਿਆ ਮੇਰੇ ਸਾਹਮਣੇ ਦੇਖਦੇ ਦੇਖਦੇ ਬਟ ਬੂਟੇ ਨੇ ਗਰੋਥ ਕਰੀ ਹੈ ਇੱਕ ਹੁਣ ਇੱਕ ਪੇੜ ਦਾ ਰੂਪ ਧਾਰਨ ਕਰ ਲਿਆ ਇਹਨੇ ਸੋ ਸਾਨੂੰ ਇਹੀ ਇੱਦਾਂ ਹੀ ਕਰਨਾ ਚਾਹੀਦਾ ਅਗਰ ਮ ਅਸੀਂ ਘਰੋਂ ਬਾਹਰ ਜਾਂਦੇ ਹਾਂ ਤਾਂ ਸਾਨੂੰ ਇੱਦਾਂ ਨਹੀਂ ਕਿ ਸਾਨੂੰ ਬੂਟਿਆਂ ਦੇ ਨਾਲ ਓਹ ਬਿਲਕੁਲ ਜੀ ਖਿਆਲ ਛੱਡ ਦੇਣਾ ਚਾਹੀਦਾ ਨਹੀਂ ਬਲਕਿ ਸਾਨੂੰ ਘਰ ਕਿਸੇ ਨਾ ਕਿਸੇ ਦਾ ਇਹ ਫਰਜ਼ ਜ਼ਰੂਰ ਬਣਦਾ ਕਿ ਅਗਰ ਇੱਕ ਪਰਸਨ ਘਰ ਤੋਂ ਬਾਹਰ ਹੈ ਤਾਂ ਦੂਜੇ ਪਰਸਨ ਨੂੰ ਪੇੜ ਪੌਦਿਆਂ ਦੀ ਚੰਗੀ ਤਰ੍ਹਾਂ ਦੇਖਭਾਲ ਕਰਨੀ ਚਾਹੀਦੀ ਹੈ ਇੱਦਾਂ ਨਹੀਂ ਕਿ ਇੱਕ ਟਾਈਮ ਪਾਣੀ ਪਾਇਆ ਜਾ ਕਿਤੇ ਇੱਕ ਤਾਂ ਇੱਕ ਦਿਨ ਪਾਣੀ ਨਹੀਂ ਪਾਇਆ ਇੱਕ ਦਿਨ ਪਾਣੀ ਪਾ ਤਾ ਇੱਦਾਂ ਨਹੀਂ ਕਰਨਾ ਚਾਹੀਦਾ ਸੋ ਇਹ ਦੇਖਭਾਲ ਕਰਨੀ ਚਾਹੀਦੀ ਹੈ ਜਿਵੇਂ ਕਿ ਮੈਂ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਰਿਹਾ ਜਦੋਂ ਮੈਂ ਘਰੋਂ ਬਾਹਰ ਗਿਆ ਤਾਂ ਮੇਰੇ ਸਿਸਟਰ ਜੀ ਮੇਰੀ ਮਾਤਾ ਜੀ ਇਹ ਬਹੁਤ ਚੰਗੇ ਤਰੀਕੇ ਦੇ ਨਾਲ ਸਾਡੇ ਮੇਰੇ ਬੂਟਿਆਂ ਦੀ ਜਿਹੜੀ ਹੈਗੀ ਦੇਖਭਾਲ ਕੀਤੀ ਸੋ ਮੈਂ ਇੱਥੋਂ ਇਹ ਗੱਲ ਬੜੇ ਮਾਣ ਨਾਲ ਕ ਕਹਿ ਸਕਦਾ ਕਿ ਮੈਂ ਨਹੀਂ ਮੈਂ ਹੀ ਨਹੀਂ ਇਕੱਲਾ ਸਗੋਂ ਮੇਰਾ ਪੂਰਾ ਪਰਿਵਾਰ ਇਹਨਾਂ ਬੂਟਿਆਂ ਦੇ ਪ੍ਰਤੀ ਬਹੁਤ ਹੀ ਪ੍ਰੇਮ ਰੱਖਦਾ ਪਿਆਰ ਰੱਖਦਾ ਆਪਾਂ ਕਹਿ ਦਈਏ ਇੱਕ ਤਰ੍ਹਾਂ ਦਾ ਕਿਉਂਕਿ ਇਹ ਬੂਟਿਆਂ ਨੂੰ ਅਸੀਂ ਪੁੱਤਾਂ ਵਾਂਗ ਪਾਲਿਆ ਹੋਇਆ ਗਾ ਅਗਰ ਅਸੀਂ ਚੰਗੀ ਤਰ੍ਹਾਂ ਇਹਨਾਂ ਦੀ ਕੇਅਰ ਕਰਦੇ ਹਾਂ ਤਾਂ ਆਉਣ ਵਾਲੇ ਟਾਈਮ 'ਚ ਇਹ ਸਾਡੀ ਕੇਅਰ ਕਰਦੇ ਕਿਉਂਕਿ ਜਦੋਂ ਆਪਾਂ ਦੇਖਦੇ ਹਾਂ ਸਮਾਂ ਲੰਘਦਾ ਗਾ ਤਾਂ ਜਦੋਂ ਬਜ਼ੁਰਗਾਂ ਦੀ ਵੱਡੇ ਬਜ਼ੁਰਗ ਹੋ ਜਾਂਦੇ ਨੇ ਘਰ ਵਿੱਚ ਵੱਡੇ ਜਿਹੜੇ ਹੈਗੇ ਨੇ ਮੰਮੀ ਪਾਪਾ ਵੱਡੇ ਹੋ ਜਾਂਦੇ ਨੇ ਤਾਂ ਉਦੋਂ ਸਾਨੂੰ ਉਸ ਟਾਈਮ ਜਦੋਂ ਬਜ਼ੁਰਗ ਆਪਾਂ ਅਕਸਰ ਹੀ ਦੇਖਦੇ ਹਾਂ ਪੇੜ ਪੌਦਿਆਂ ਦੀ ਛਾਂਵ ਥੱਲੇ ਬਹਿੰਦੇ ਨੇ ਤਾਂ ਉਦੋਂ ਬੜਾ ਹੀ ਮਾਣ ਮਹਿਸੂਸ ਕਰਦੇ ਨੇ ਠੰਡੀ ਹਵਾ ਥੱਲੇ ਬਹਿੰਦੇ ਨੇ ਗੱਲਾਂ ਕਰਦੇ ਨੇ ਛੋਟੇ ਬੱਚਿਆਂ ਨੂੰ ਗੱਲਾਂ ਸਿਖਾਉਂਦੇ ਨੇ ਵੀ ਇੱਕ ਟਾਇਮ ਸੀ ਉਹ ਦੌਰ ਸੀ ਜਦੋਂ ਅਸੀਂ ਇਹਨਾਂ ਬੂਟਿਆਂ ਨੂੰ ਪਾਲ ਲਿਆ ਸਾਡੇ ਕਈ ਵਾਰ ਬੱਚੇ ਮੰਨ ਲਓ ਘਰ ਨਹੀਂ ਹੁੰਦੀ ਸੀ ਤਾਂ ਉਸ ਟਾਈਮ ਅਸੀਂ ਇਹਨਾਂ ਦੀ ਕੇਅਰ ਕਰਦੇ ਸੀ ਸੋ ਆਖਿਰ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ ਵੀ ਜਦੋਂ ਮੈਂ ਕਈ ਵਾਰ ਇੱਦਾਂ ਘਰੋਂ ਗਿਆ ਤਾਂ ਮੇਰੀ ਮਾਤਾ ਜੀ ਨੇ ਮੇਰੀ ਸਿਸਟਰ ਨੇ ਬਹੁਤ ਚੰਗੀ ਤਰੀਕੇ ਦੇ ਨਾਲ ਬਲਕਿ ਮੈਥੋਂ ਵੀ ਜ਼ਿਆਦਾ ਚੰਗੇ ਤਰੀਕੇ ਨਾਲ ਇਹਨਾਂ ਦੀ ਕੇਅਰ ਕਰੀ ਅਤੇ ਇਹਨਾਂ ਦੀ ਬਦੌਲਤ ਅੱਜ ਮੇਰੇ ਪੇੜ ਪੌਦੇ ਹੋਰ ਜ਼ਿਆਦਾ ਅੱਗੇ ਤੋਂ ਹੋਰ ਜ਼ਿਆਦਾ ਜਿਹੜੇ ਹੈਗੇ ਨੇ ਉਹ ਡਿਵੈਲਪ ਹੋ ਚੁੱਕੇ ਨੇ ਇੱਕ ਛੋਟਾ ਬੂਟਾ ਮੇਰਾ ਜੋ ਹੈ ਹੁਣ ਵੱਡਾ ਦਰਖਤ ਬਣ ਰਿਹਾ ਸੋ ਮੈਨੂੰ ਹਰ ਇੱਕ ਨੂੰ ਇਹੀ ਜਿਹੜਾ ਹੈਗੀ ਆ ਸੰਦੇਸ਼ ਦੇਣਾ ਚਾਹੀਦਾ ਹੈਗਾ ਅਤੇ ਹਰ ਇੱਕ ਨੂੰ ਇਹ ਸੰਦੇਸ਼ ਮੰਨਣਾ ਚਾਹੀਦਾ ਹੈਗਾ ਹਰ ਇੱਕ ਨੂੰ ਇਹ ਗੱਲ ਜਿਹੜੀ ਹੈਗੀ ਆ ਉਹ ਮੰਨਣੀ ਚਾਹੀਦੀ ਹੈ ਕਿ ਆਪਣੇ ਘਰ ਵਿੱਚ ਬੂਟਿਆਂ ਨਾਲ ਪ੍ਰੇਮ ਬਣਾ ਕੇ ਰੱਖੀਏ ਇਹਨਾਂ ਦੀ ਦੇਖਭਾਲ ਕਰੀਏ ਅਤੇ ਇੱਕ ਸਮੇਂ ਮੰਨ ਲਓ ਅਸੀਂ ਘਰੋਂ ਚਲੇ ਜਾਂਦੇ ਹਾਂ ਤਾਂ ਇੱਕ ਪਰਸਨ ਦੀ ਜ਼ਰੂਰ ਡਿਊਟੀ ਲਗਾਈਏ ਕਿ ਇਹਨਾਂ ਪੇੜ ਪੌਦਿਆਂ ਦੀ ਦੇਖਭਾਲ ਕਰੇ ਸੋ ਇਹ ਅੱਜ ਦੇ ਮੰਨਲੋ ਜੇ ਆਪਾਂ ਕਹਿ ਦਈਏ ਬਹੁਤ ਸਾਡੇ ਲਈ ਸੋਚਮੰਦ ਗੱਲ ਹੈ ਕਿਉਂਕਿ ਦਿਨੋਂ ਦਿਨ ਕੀ ਹੈ ਆਪਾਂ ਨੂੰ ਦੇਖਦੇ ਹਾਂ ਵੀ ਜੰਨਸੰਖਿਆ ਵੱਧ ਰਹੀ ਹੈ ਜਨਸੰਖਿਆ ਵੱਧ ਰਹੀ ਹੈ ਤਾਂ ਪਾਪੂਲੇਸ਼ਨ ਵੱਧ ਰਹੀ ਹੈ ਇੱਕ ਤਰ੍ਹਾਂ ਦੀ ਆਪਾਂ ਕਹਿ ਦਈਏ ਤਾਂ ਮਕਾਨ ਬਣਨੇ ਸ਼ੁਰੂ ਹੋ ਰਹੇ ਨੇ ਮਕਾਨ ਕਿਵੇਂ ਬਣਨਗੇ ਮਕਾਨ ਇਹਨਾਂ ਦਰਖਤਾਂ ਨੇ ਕਟਾਈ ਹੋ ਰਹੀ ਹੈ ਲੱਕੜ ਘਰਾਂ ਵਿੱਚ ਯੂਜ ਹੋ ਰਹੀ ਹੈ ਸੋ ਦਰਖਤ ਦਿਨੋਂ ਦਿਨ ਘੱਟ ਰਹੇ ਨੇ ਇਸ ਲਈ ਸਾਨੂੰ ਥੋੜ੍ਹਾ ਜਿਹਾ ਹੈਗਾ ਜਿਹੜਾ ਹੈਗਾ ਸਾਨੂੰ ਇਹਨਾਂ ਪ੍ਰਤੀ ਜਾਗਰੂਕ ਹੋਣਾ ਪਵੇਗਾ ਸਾਨੂੰ ਦਰਖਤਾਂ ਦੇ ਪ੍ਰਤੀ ਆਪਣੀ ਚੰਗੀ ਸੋਚ ਰੱਖਣੀ ਚਾਹੀਦੀ ਹੈ ਵੱਧ ਤੋਂ ਵੱਧ ਦਰਖਤ ਲਗਾਈਏ ਸੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਕ ਚੰਗਾ ਜੀਵਨ ਜਿਹੜਾ ਹੈਗੀ ਹੈ ਉਹ ਜਿਉਂ ਸਕੀਏ ਇਸ ਲਈ ਮੈਂ ਆਖਿਰ ਵਿੱਚ ਇਹੀ ਕਹਿਣਾ ਚਾਹੁੰਦਾ ਗਾ ਕਿ ਪੇੜ ਪੌਦਿਆਂ ਦੀ ਚੰਗੀ ਕੇਅਰ ਹੈਗੀ ਆ ਜਿਹੜੀ ਉਹ ਮੇਰੇ ਤੋਂ ਇਲਾਵਾ ਮੇਰੇ ਘਰਦਿਆਂ ਨੇ ਵੀ ਰੱਖੀ ਹੈ